ਹੈਲੋ ਹਾਂਜੀ ਸਰ ਮੈਂ ਸਵਿਗੀ ਤੋਂ ਔਡਰ ਲੈਣਾ ਚਾਹੁੰਦਾ ਵਾਂ ਅਤੇ ਮੈਨੂੰ ਤੁਸੀਂ ਨਾ ਇੱਕ ਪੀਜ਼ਾ ਫੁੱਲ ਸਾਈਜ਼ ਚੀਜ਼ ਵਾਲਾ ਅਤੇ ਇੱਕ ਬਰਗਰ ਚੀਜ਼ ਵਾਲਾ ਕਰ ਦਿਓ ਅਤੇ ਪੇਮੈਂਟ ਜਿਹੜੀ ਆ ਤੁਸੀਂ ਕੈਸ਼ ਕਰੋਗੇ ਕਿਸ ਤਰ੍ਹਾਂ ਕਰੋਗੇ ਅੱਛਾ ਕੈਸ਼ ਅਤੇ ਸਰ ਤੁਸੀਂ ਕਿੰਨੀ ਕੁ ਦੇਰ ਤੱਕਰ ਆ ਜੋਗੇ ਅੱਧੇ ਘੰਟੇ ਤੱਕ ਅੱਛਾ ਅੱਧੇ ਘੰਟੇ ਤੱਕ ਤੁਸੀਂ ਪਲੀਜ਼ ਸਰ ਮੈਨੂੰ ਨਾ ਜਲਦੀ ਔਡਰ ਭੇਜ ਦਿਓ ਕਿਉਂਕਿ ਮੈਨੂੰ ਜ਼ਰੂਰੀ ਹੈ ਫੰਕਸ਼ਨ ਹੈ ਘਰ ਵਿੱਚ ਆਇਆ ਹੋਇਆ ਕੋਈ ਅਤੇ ਉਹਦੇ ਲਈ ਚਾਹੀਦਾ ਸੀ ਅਤੇ ਅੱਛਾ ਅੱਛਾ ਠੀਕ ਆ ਅਤੇ ਅੱਛਾ ਲੋਕੇਸ਼ਨ ਲੋਕੇਸ਼ਨ ਸਰ ਤੁਸੀਂ ਮੈਂ ਨੰਬਰ ਫੀਡ ਕਰ ਲਓ ਅਤੇ ਲੋਕੇਸ਼ਨ ਮੇਰੇ ਫੋਨ 'ਤੇ ਆ ਜਾਂਦੀ ਆ ਅਤੇ ਤੁਸੀਂ ਸਰ ਜਲਦੀ ਥੋੜ੍ਹਾ ਕਰ ਦੇਣਾ ਮੈਨੂੰ ਭੇਜ ਦਿਓ ਬਰਗਰ ਅਤੇ ਪੀਜ਼ਾ ਹਾਂਜੀ ਚੀਜ਼ ਪ ਪੀਜ਼ਾ ਹੈਗਾ ਮੇਰਾ ਠੀਕ ਅੱਛਾ ਸਰ ਕੂਪਨ ਵੀ ਸਰ ਮੇਰਾ ਕੂਪਨ ਮੈਂ ਲਗਾ ਕੂਪਨ ਅਗਰ ਮੈਂ ਔਡਰ ਕਰਾਂ ਅਤੇ ਕੂਪਨ ਮੈਂ ਲਗਾ ਸਕਦਾ ਵਾਂ ਅਗਰ ਮੈਂ ਐਪ ਤੋਂ ਕਰਾਂ ਅਤੇ ਅੱਛਾ ਲਗਾ ਸਕਦਾ ਵਾਂ ਠੀਕ ਠੀਕ ਸਰ ਮੈਂ ਕੂਪਨ ਲਗਾ ਕੇ ਦੇਖ ਲਾ ਮੈਨੂੰ ਕਿੰਨੀ ਪਰਸੈਂਟ ਔਫ ਮਿਲਦੀ ਹੈ ਅਤੇ ਫਿਰ ਮੈਂ ਉਸ ਹਿਸਾਬ ਨਾਲ ਦੱਸ ਦਿੰਦਾ ਅਤੇ ਐਡਰੈਸ ਸਰ ਤੁਸੀਂ ਲਿਖ ਲਉ ਫਿਰ ਐਡਰੈਸ ਸਰ ਸ਼ਰਮਾ ਕਲੋਨੀ ਗਲੀ ਨੰਬਰ ਤਿੰਨ ਹਾਂਜੀ ਅਤੇ ਹਾਊਸ ਨੰਬਰ ਪੰਦਰ੍ਹਾਂ ਸੌ ਅਠਾਸੀ ਠੀਕ ਠੀਕ ਠੀਕ ਹੈ ਸਰ ਅਤੇ ਰੈਸਟੋਰੈਂਟ ਸਰ ਰੈਸਟੋਰੈਂਟ ਸਰ ਜਿਹੜਾ ਔਡਰ ਲੈਣਾ ਉਹ ਜਿਹੜਾ ਸਭ ਤੋਂ ਵਧੀਆ ਰੈਸਟੋਰੈਂਟ ਤੋਂ ਮੰਗਵਾਉਣਾ ਕੋਈ ਮੈਨੂੰ ਕਿਉਂਕਿ ਜਿਹੜੇ ਗੈਸਟ ਆਏ ਨੇ ਉਹ ਕਾਫੀ ਸਪੈਸ਼ਲ ਗੈਸਟ ਹੈਗੇ ਨੇ ਇਸ ਕਰਕੇ ਤੁਸੀਂ ਸਭ ਤੋਂ ਵਧੀਆ ਉਹ ਰੈਸਟੋਰੈਂਟ ਤੋਂ ਮਤਲਬ ਕਿ ਜੋ ਵੀ ਹੈ ਉਹ ਪੀਜ਼ਾ ਬਰਗਰ ਭੇਜਣਾ ਪੈਸੇ ਚਾਹੇ ਜਿੰਨੇ ਮਰਜ਼ੀ ਲੱਗ ਜਾਣ ਕੋਈ ਗੱਲ ਨਹੀਂ ਹੈਗੀ